ਪੰਜਾਬ ਵਿੱਚ ਜੀਵਨ ਦੇ ਢੰਗ ਨੂੰ ਆਕਾਰ ਦੇਣ ਵਾਲੀ ਸਭ ਤੋਂ ਪ੍ਰਮੁੱਖ ਚੀਜ਼ ਹੈਗੀ ਹੈ ਭਾਸ਼ਾ ਕਿਉਂਕਿ ਜਿਹੜੀ ਭਾਸ਼ਾ ਹੈਗੀ ਆ ਉਹ ਆਪਾਂ ਬਚਪਨ ਤੋਂ ਹੀ ਸਿੱਖਨੀ ਸ਼ੁਰੂ ਕਰ ਦਿੰਦੇ ਹਾਂ ਆਪਣੀ ਮਾਂ ਤੋਂ ਜੋ ਆਪਣੀ ਮਾਂ ਬੋਲੀ ਹੁੰਦੀ ਆ ਉਹ ਆਪਾਂ ਸਿੱਖਦੇ ਹੈਗੇ ਹਾਂ ਅਤੇ ਪੰਜਾਬ ਵਿੱਚ ਆਪਣੀ ਮਾਂ ਬੋਲੀ ਹੈ ਉਹ ਹੁੰਦੀ ਹੈ ਪੰਜਾਬੀ ਅਤੇ ਆਪਾਂ ਜਿਹੜੇ ਜੀਵਨ ਨੂੰ ਕੀ ਆ ਪ੍ਰਮੁੱਖ ਕੀ ਆ ਆਕਾਰ ਦਿੰਦੇ ਹੈਗੇ ਹਾਂ ਆਪਾਂ ਕਿਸੇ ਨਾਲ ਕੰਨਵਰਸੇਸ਼ਨ ਕਰਨੀ ਹੁੰਦੀ ਆ ਤਾਂ ਆਪਾਂ ਆਪਣੀ ਮਾਂ ਬੋਲੀ ਨਾਲ ਹੀ ਕਰਦੇ ਹੈਗੇ ਹਾਂ ਜਦੋਂ ਆਪਾਂ ਆਪਣੀ ਮਾਂ ਬੋਲੀ ਨਾਲ ਗੱਲ ਕਰਦੇ ਹੈਗੇ ਹਾਂ ਤਾਂ ਆਪਾਂ ਨੂੰ ਸਾਰੀ ਸਮਝ ਲੱਗਦੀ ਹੈਗੀ ਆ ਅਤੇ ਜੇਕਰ ਆਪਾਂ ਦੇਸ਼ ਵਿਦੇਸ਼ਾਂ 'ਚ ਵੀ ਜਾਂਦੇ ਹੈਗੇ ਹਾਂ ਅਤੇ ਉੱਥੇ ਜਦੋਂ ਆਪਾਂ ਗੱਲ ਆਪਾਂ ਆਪਣੀ ਪੰਜਾਬੀ 'ਚ ਕਰਦੇ ਹੈਗੇ ਹਾਂ ਤਾਂ ਪਤਾ ਲੱਗ ਜਾਂਦਾ ਵਾ ਕਿ ਆਪਾਂ ਪੰਜਾਬ ਤੋਂ ਹੀ ਬਿਲੋਂਗ ਕਰਦੇ ਹੈਗੇ ਹਾਂ ਇਸ ਕਰਕੇ ਭਾਸ਼ਾ ਦਾ ਮਤਲਬ ਆਪਣੇ ਜੀਵਨ ਦੇ ਢੰਗ ਵਿੱਚ ਕੀ ਆ ਆਪਣੇ ਜੀਵਨ 'ਚ ਕੀ ਆ ਪ੍ਰਮੁੱਖ ਉਹਦਾ ਕੀ ਰੋਲ ਹੈਗਾ ਵਾ